ਸਤਿ ਸ਼੍ਰੀ ਅਕਾਲ ਜੀ ਮੈਂ ਮਾਨਸੀ ਗੱਲ ਕਰ ਰਹੀ ਹਾਂ ਮੈਂ ਤੁਹਾਡੀ ਇੰਸਟਾਗਰਾਮ ਆਈਡੀ ਤੋਂ ਪੰਦਰਾਂ ਦਿਨ ਪਹਿਲਾਂ ਇੱਕ ਲੈਪਟਾਪ ਬੁੱਕ ਕੀਤਾ ਸੀ ਜੋ ਮੇਰੇ ਕੋਲ ਪਹੁੰਚ ਗਿਆ ਹੈ ਇਸ ਦੀ ਪੈਕਿੰਗ ਦੀ ਗੱਲ ਕਰੀਏ ਤਾਂ ਇਸਦੀ ਪੈਕਿੰਗ ਬਹੁਤ ਜ਼ਿਆਦਾ ਹੀ ਵਧੀਆ ਲੱਗੀ ਮੈਨੂੰ ਅਤੇ ਇਸ ਦਾ ਜਿਹੜਾ ਕਲਰ ਸੀਗਾ ਉਹ ਬਲੈਕ ਸੀਗਾ ਜੋ ਬਹੁਤ ਸ ਬਹੁਤ ਜ਼ਿਆਦਾ ਸੋਹਣਾ ਅਤੇ ਸ਼ਾਈਨਿੰਗ ਦੇ ਵਿੱਚ ਵੀ ਹੈਗਾ ਇਸ ਦਾ ਪ੍ਰੋਸੈਸ ਵੀ ਬਹੁਤ ਜ਼ਿਆਦਾ ਵਧੀਆ ਇਹ ਹੈਂਗ ਨਹੀਂ ਹੁੰਦਾ ਅਤੇ ਮੈਨੂੰ ਇਹਨੂੰ ਇਸਤੇਮਾਲ ਕਰਦੇ ਹੋਏ ਨੂੰ ਵੀ ਘੱਟੋ ਘੱਟ ਇੱਕ ਮਹੀਨਾ ਹੋ ਗਿਆ ਹੈ ਇਸਦੀ ਡਿਸਪਲੇ ਵੀ ਐਚਡੀ ਹੈ ਅਤੇ ਬਹੁਤ ਵਧੀਆ ਇਹ ਵਰਕ ਕਰ ਰਿਹਾ ਹੈ ਕੀਵਰਡ ਅਤੇ ਮਾਊਸ ਹੈ ਜਿਹੜਾ ਇਹ ਵੀ ਬਹੁਤ ਜ਼ਿਆਦਾ ਸਮੂਥ ਹੈ ਅਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਇਸਦੇ ਹੀਟ ਹੀਟ ਦੀ ਗੱਲ ਕਰੀਏ ਤਾਂ ਮੈਂ ਆਪਣਾ ਕਾਲਜ ਦਾ ਕੰਮ ਹੈ ਜਿਹੜਾ ਜੋ ਹੋਰ ਵੀ ਕੋਈ ਕੰਮ ਹੈ ਮੈਂ ਬਹੁਤ ਲਗਾਤਾਰ ਕਰਦੀ ਹਾਂ ਲਗਾਤਾਰ ਇੱਕ ਦੋ ਘੰਟੇ ਤੱਕ ਮੈਂ ਉਸਨੂੰ ਕਰਦੀ ਰਹਿੰਦੀ ਆ ਬਟ ਇਹ ਹੀਟ ਨਹੀਂ ਕਰਦਾ ਇਹ ਬਹੁਤ ਹੀ ਵਧੀਆ ਸਰਵਿਸ ਦੇ ਰਿਹਾ ਹੈ ਲਾਈਟ ਵੇਟ ਹੈ ਇਹ ਬਹੁਤ ਜ਼ਿਆਦਾ ਹੀ ਹਲਕਾ ਹੈ ਮੈਂ ਇਸਨੂੰ ਕਿਤੇ ਵੀ ਲੈ ਕੇ ਜਾਣਾ ਹੋਵੇ ਬੈਗ ਦੇ ਵਿੱਚ ਪਾ ਕੇ ਕਾਲਜ ਜਾਂ ਕਿਤੇ ਹੋਰ ਮੈਂ ਇਸ ਨੂੰ ਆਸਾਨੀ ਨਾਲ ਲੈ ਕੇ ਜਾ ਸਕਦੀ ਹੈ ਬਿਲਕੁਲ ਵੀ ਭਾਰੀ ਨਹੀਂ ਹੈਗਾ ਅਤੇ ਇਸਦੇ ਚਾਰਜਰ ਦੀ ਗੱਲ ਕਰੀਏ ਤਾਂ ਇਸਦਾ ਚਾਰਜਰ ਵੀ ਬਹੁਤ ਜ਼ਿਆਦਾ ਵਧੀਆ ਹੈ ਅਤੇ ਬਹੁਤ ਘੱਟ ਟਾਈਮ ਦੇ ਵਿੱਚ ਇਹ ਚਾਰਜ ਕਰ ਦਿੰਦਾ ਹੈ ਅਤੇ ਮੈਂ ਆਪਣੇ ਫਰੈਂਡਸ ਨੂੰ ਵੀ ਇਹ ਇਹਦੇ ਇਸ ਨੂੰ ਲੈਣ ਬਾਰੇ ਸਜੈਸਟ ਕਰਾਂਗੀ ਕਿਉਂਕਿ ਇਹ ਬਹੁਤ ਜ਼ਿਆਦਾ ਹੀ ਵਧੀਆ ਅਤੇ ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਹੈ ਅਤੇ ਜਿਹੜੇ ਤੁਹਾਡੇ ਵੀਹ ਪ੍ਰਸੈਂਟ ਦੀ ਗੱਲ ਹੈ ਮੈਂ ਆਪਣੇ ਹਰੇਕ ਦੋਸਤ ਤੱਕ ਪਹੁੰਚਾਵਾਂਗੀ ਤਾਂ ਕਿ ਉਹ ਤੁਹਾਡੇ ਹੀ ਆਈਡੀ ਤੋਂ ਇਹ ਲੈਪਟਾਪ ਲੈਣ ਧੰਨਵਾਦ